ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਅਸੀਂ ਨਾ ਸਾਡੀ ਕੰਪਨੀ ਨੇ ਨਾ ਕਾਫੀ ਰਿਸਰਚ ਕੀਤੀ ਆ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਕੋਲੋਂ ਇਸ ਰਿਸਰਚ ਬਾਰੇ ਹੋਰ ਡਾਟਾ ਪੰਜਾਬ ਦੇ ਸੰਬੰਧ ਵਿੱਚ ਇਕੱਠਾ ਕੀਤਾ ਜਾਵੇ ਕਿ ਪੰਜਾਬ ਨੇ ਐਗਰੀਕਲਚਰ ਨੇ ਪੰਜਾਬ ਨੂੰ ਕਿਸ ਤਰ੍ਹਾਂ ਅਮੀਰ ਬਣਾਇਆ ਇਹਦੇ ਬਾਰੇ ਕੁਛ ਚਾਨਣਾ ਪਾਓਗੇ ਠੀਕ ਹੈ ਮੈਮ ਬਿਲਕੁਲ ਹਾਂਜੀ ਠੀਕ ਹੈ ਮੈਮ ਹਾਂਜੀ ਹਾਂਜੀ

ਠੀਕ ਠੀਕ ਹੈ ਮੈਡਮ ਠੀਕ ਜੀ

ਠੀਕ ਆ ਮੈਡਮ ਪੰਜਾਬ ਦੇ ਬਾਰੇ ਤੁਸੀਂ ਜਾਣਕਾਰੀ ਦਿੱਤੀ ਅਤੇ ਤੁਹਾਡਾ ਇਸ ਕੰਮ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ